ਮੇਰਾ ਨਾਮ ਬਰਿੰਦਰ ਸਿੰਘ ਮੈਂ ਇੱਕ ਐਕਸਪੀਰੀਅੰਸ ਬਾਰੇ ਦੱਸਣਾ ਚਾਹੁੰਦਾ ਅਸੀਂ ਇੱਕ ਜੁੱਤੀ ਮੰਗਵਾਈ ਸੀ ਐਮਾਜੋਨ ਤੋਂ ਜੁੱਤੀ ਦਾ ਜਿਹੜਾ ਲੈਦਰ ਆ ਬਹੁਤ ਵਧੀਆ ਕੁਆਲਿਟੀ ਦਾ ਸੀ ਉਹ ਜੁੱਤੀ ਮੇਰੇ ਰਿਸ਼ਤੇਦਾਰਾਂ ਨੇ ਮੇਰੇ ਦੋਸਤਾਂ ਨੇ ਮਿੱਤਰਾਂ ਨੇ ਸਾਰਿਆਂ ਨੇ ਬਹੁਤ ਪਸੰਦ ਕੀਤੀ ਉਹ ਜੁੱਤੀ ਨੂੰ ਪਸੰਦ ਕਰਕੇ ਉਹਨਾਂ ਨੇ ਵੀ ਔਡਰ ਕੀਤੀ ਅਤੇ ਉਹ ਹੁਣ ਤੱਕ ਚੱਲ ਰਹੀ ਆ ਜੁੱਤੀ ਕਾਫੀ ਲੰਬਾ ਸਮਾਂ ਹੋ ਗਿਆ

ਹੋਰ ਵੀ ਬਹੁਤ ਜੁੱਤੀਆਂ ਸੀ ਪਰ ਉਹਦਾ ਮ ਜੋ ਸੋਲ ਲੱਗਿਆ ਸੀ ਉਹਨੂੰ ਬਹੁਤ ਵਧੀਆ ਅਤੇ ਘੱਟ ਅਮਾਊਂਟ ਸੀ ਉਹਦੀ ਘੱਟ ਰੇਟ ਸੀਗਾ ਅਤੇ ਜੁੱਤੀ ਬੜਾ ਬਹੁਤ ਲੰਬਾ ਸਮਾਂ ਚੱਲੀ ਬਹੁਤ ਵਧੀਆ